ਨਹੀਂ ਨਹੀਂ ਕਲਪਨਾ ਚਾਵਲਾ ਸੁਨੀਤਾ ਵਿਲੀਅਮ ਜਾਂ ਰਾਕੇਸ਼ ਸ਼ਰਮਾ ਬਾਰੇ ਮੈਂ ਕੁਝ ਜ਼ਿਆਦਾ ਨਹੀਂ ਜਾਣਦਾ ਹਾਂਜੀ ਮੈਂ ਪੜ੍ਹਿਆ ਸੀਗਾ ਅਤੇ ਇਹੀ ਮੈਂ ਕੁਝ ਅੱਠਵੀਂ ਨੌਵੀਂ ਦੀ ਕਿਤਾਬਾਂ ਵਿਚ ਪੜ੍ਹਿਆ ਹੈਗਾ ਉਹਨਾਂ ਬਾਰੇ ਅਤੇ ਇਸ ਕਰਕੇ ਮੈਂ ਕੁਝ ਬੋਲਣਾ ਨਹੀਂ ਚਾਹੂੰਗਾ ਇਸ ਬਾਰੇ ਕਿਉਂਕਿ ਮੈਨੂੰ ਇਸ ਚੀਜ਼ ਬਾਰੇ ਕਾਫੀ ਪਤਾ ਨਹੀਂ ਆ ਅਤੇ ਜੇਕਰ ਮਤਲਬ ਥੋੜ੍ਹਾ ਬਹੁਤਾ ਮੈਨੂੰ ਆਈਡੀਆ ਹੈਗਾ ਕਿ ਉਹਨਾਂ ਨੇ ਕੀ ਕੀ ਕੀਤਾ ਅਤੇ ਕੀ ਕੀ ਉਪਲਬਧੀ ਹਾਸਲ ਕੀਤੀ ਸੀਗੀ ਅਤੇ ਉਹਦੇ ਕਰਕੇ ਉਸ ਚੀਜ਼ ਵਿੱਚ ਮੈਂ ਕਹਿ ਸਕਦਾ ਕਿ ਹਾਂ ਉਹਨਾਂ ਨੇ ਭਾਰਤ ਦਾ ਕਾਫੀ ਮਾਨ ਵਧਾਇਆ ਇੰਟਰਨੈਸ਼ਨਲ ਲੈਵਲ 'ਤੇ ਅਤੇ ਕਾਫੀ ਵੱਡੇ ਮਤਲਬ ਲੋਕਾਂ ਨੂੰ ਉਹਨਾਂ ਤੋਂ ਸਿੱਖ ਲੈਣੀ ਚਾਹੀਦੀ ਏ ਜਿਹੜੇ ਬੱਚੇ ਅੱਜ ਕੱਲ੍ਹ ਸਾਰਾ ਕੰਮਕਾਰ ਛੱਡ ਕੇ ਵਿਹਲੇ ਬੈਠੇ ਆ ਅਤੇ ਉਹਨਾਂ ਨੂੰ ਇਹਨਾਂ ਚੀਜ਼ਾਂ ਤੋਂ ਸਿੱਖਣਾ ਚਾਹੀਦਾ ਅਤੇ ਇਹਨਾਂ ਵਰਗੀ ਇਹਨਾਂ ਤੋਂ ਪ੍ਰੇਰਨਾ ਲੈ ਕੇ ਅੱਗੇ ਕੁਛ ਵੱਡਾ ਕਰਨਾ ਚਾਹੀਦਾ ਆਪਣੇ ਦੇਸ਼ ਲਈ ਜਿਵੇਂ ਵੀ ਰਾਕੇਸ਼ ਸ਼ਰਮਾ ਦਾ ਮੈਂ ਜਾਣਦਾ ਥੋੜ੍ਹਾ ਬਹੁਤਾ ਕਿ ਉਹਨਾਂ ਨੇ ਫਸਟ ਸਾਇੰਟਿਸਟ ਸਪੇਸ ਸਾਇੰਟਿਸਟ ਸੀਗੇ ਜਿਹੜੇ ਬਾਹਰ ਗਏ ਸੀਗੇ ਇੰਡੀਆ ਵੱਲੋਂ ਅਤੇ ਕਲਪਨਾ ਚਾਵਲਾ ਤਾਂ ਨਾਸਾ ਕੰਮ ਕਰਦੀ ਸੀਗੀ ਅਤੇ ਸੁਨੀਤਾ ਵਿਲੀਅਮਸ ਬਾਰੇ ਮੈਂ ਜ਼ਿਆਦਾ ਨਹੀਂ ਜਾਣਦਾ ਅਤੇ ਹਾਂਜੀ ਇਹਨਾਂ ਨੇ ਭਾਰਤ ਦਾ ਮਾਣ ਵਧਾਇਆ ਇੰਟਰਨੈਸ਼ਨਲ ਲੈਵਲ 'ਤੇ